ਸਾਡੇ ਪਿੰਡ ਦੇ ਬਜ਼ੁਰਗ ਪਿੱਪਲ ਹੇਠ ਬੈਠ ਕੇ ਆਪਣਾ ਸਮਾਂ ਬਤੀਤ ਕਰਨ ਲਈ ਗੱਲਾਂ ਬਾਤਾਂ ਕਰਦੇ ਹਨ ਅਤੇ ਤਾਸ਼ ਵੀ ਖੇਡਦੇ ਹਨ ਜਿਵੇਂ ਕਿ ਭਾਬੀ ਇਰਸਣ ਚੁਰਸਣ ਰੰਗ ਆਦਿ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਗੇਮਾਂ ਖੇਡਦੇ ਹਨ ਕਈ ਜੋ ਬਜ਼ੁਰਗ ਸਾਡੇ ਪਿੰਡ ਦੇ ਸਵਸਥ ਹਨ ਉਹ ਭਲਵਾਨੀ ਵੀ ਕਰਦੇ ਹਨ ਅਤੇ ਆਪਣੇ ਜਿਹੜੇ ਬੱਚੇ ਹੈ ਉਨ੍ਹਾਂ ਨੂੰ ਵੀ ਭਲਵਾਨੀ ਸਿਖਾਉਂਦੇ ਹਨ ਅਤੇ ਕਈ ਬਜ਼ੁਰਗ ਮੈਰਾਥੋਨ ਵਗੈਰਾ ਦੌੜਾਂ ਵਗੈਰਾ 'ਚ ਹਿੱਸਾ ਵੀ ਲੈਂਦੇ ਹਨ ਅਤੇ ਖੇਤੀਬਾੜੀ ਵੀ ਕਰਦੇ ਹਨ

ਆਪਣੇ ਸਮਾਂ ਬਤੀਤ ਕਰਨ ਲਈ ਉਹ ਗੱਲਾਂ ਬਾਤਾਂ ਦੇ ਨਾਲ਼ ਨਾਲ਼